ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅੱਜ ਅਸੀਂ ਪੱਗ ਬੰਨ੍ਹਣ ਦੇ ਬਾਰੇ ਵਿੱਚ ਕੁਛ ਗੱਲ ਕਰਦੇ ਹਾਂ ਜੇ ਅਸੀਂ ਪੱਗ ਬੰਨਣ ਦੀ ਗੱਲ ਕਰੀਏ ਤਾਂ ਪੱਗ ਦੇ ਅਲੱਗ ਅਲੱਗ ਸਟਾਈਲ ਹਨ ਜਦੋਂ ਅਸੀਂ ਪੱਗਾਂ ਦੇ ਅਲੱਗ ਅਲੱਗ ਸਟਾਈਲ ਦੇਖਦੇ ਹਾਂ ਤਾਂ ਉਹਨਾਂ ਵਿੱਚ ਪਟਕੇ ਵਾਲੀ ਪੱਗ ਤੁਰਲੇ ਵਾਲੀ ਪੱਗ ਪਲੇਨ ਪੱਗ ਕੁਛ ਹੋਰ ਕਿਸਮਾਂ ਦੇ ਪੱਗਾਂ ਦੇ ਨਾਂ ਵੀ ਆਉਂਦੇ ਹਨ ਅਤੇ ਜਦੋਂ ਅਸੀਂ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਹਨ ਉਹ ਭੰਗੜੇ ਵਿੱਚ ਪੱਗਾਂ ਬੰਨ੍ਹਦੇ ਹਨ ਜਦੋਂ ਉਹ ਭੰਗੜੇ ਵਿੱਚ ਪੱਗ ਬੰਨਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਸਿਰ 'ਤੇ ਇੱਕ ਚਿੱਟਾ ਜਾਂ ਕਾਲਾ ਕੱਪੜਾ ਬਥੋੜਾ ਜਿਹਾ ਮੱਥੇ ਅੱਗੇ ਬੰਨ੍ਹ ਕੇ ਫਿਰ ਉਹਦੇ ਉੱਤੇ ਉਹ ਤੁਰਲੇ ਵਾਲੀ ਪੱਗ ਬੰਨਦੇ ਹਨ ਅਤੇ ਜਿਹੜੀ ਪੱਗ ਉਹਨਾਂ ਨੂੰ ਬਹੁਤ ਹੀ ਫੱਬਦੀ ਹੈ ਅਸੀਂ ਪੱਗ ਬੰਨ੍ਹਣ ਦੀ ਗੱਲ ਕਰੀਏ ਤਾਂ ਵਿਆਹ ਸ਼ਾਦੀ ਵਿੱਚ ਵੀ ਪੱਗ ਬੰਨ੍ਹੀ ਜਾਂਦੀ ਹੈ ਪਹਿਲੇ ਤਾਂ ਲਾੜੇ ਦੇ ਸਿਹਰੇ ਉੱਤੇ ਥੱਲੇ ਪੱਗ ਬੰਨ੍ਹੀ ਜਾਂਦੀ ਹੈ ਫਿਰ ਉਸ 'ਤੇ ਸਿਹਰਾ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਵੀ ਉਸਦੇ ਪਿਤਾ ਜੀ ਮਾਮਾ ਚਾਚਾ ਤਾਏ ਫੁੱਫੜ ਸਾਰਿਆਂ ਨੂੰ ਪੱਗਾਂ ਬਨਾਈਆਂ ਜਾਂਦੀਆਂ ਹਨ ਉਹ ਸਾਰੀਆਂ ਪੱਗਾਂ ਪਿਆਜ਼ੀ ਰੰਗ ਦੀਆਂ ਹੁੰਦੀਆਂ ਹਨ ਅਤੇ ਉਹ ਬੜੀ ਹੀ ਸ਼ਾਨ ਵਾਲੀਆਂ ਪੱਗਾਂ ਹੁੰਦੀਆਂ ਹਨ ਅਤੇ ਉਹ ਉਸ ਨਾਲ ਬਰਾਤ ਜਿਹੜੀ ਆ ਬਹੁਤ ਹੀ ਸੱਜਦੀ ਹੈ ਪੱਗ ਦੀ ਮਹੱਤਤਾ ਇੰਨੀ ਹੈ ਕਿ ਪੱਗ ਸੋਹਣੀ ਲੱਗਦੀ ਹੈ ਪੱਗ ਬੰਨਣ ਲਈ ਜਿਹੜੇ ਸਾਡੇ ਸਰਦਾਰ ਭਾਈਚਾਰੇ ਦੇ ਲੋਕ ਹਨ ਉਹ ਓ ਇੰਨੇ ਖੁਸ਼ ਹੁੰਦੇ ਹਨ ਕਿ ਪੱਗ ਉਹਨਾਂ ਦੀ ਇੱਕ ਸ਼ਾਨ ਹੈ ਪ ਪੱਗ ਪ ਪਸੰਦੀਦਾ ਸਟਾਈਲ ਪੱਗ ਬੰਨ੍ਹਣ ਦਾ ਇਹ ਹੈ ਕਿ ਜਿਹੜੀ ਤੁਰਲੇ ਵਾਲੀ ਪੱਗ ਹੁੰਦੀ ਹੈ ਉਹ ਬਹੁਤ ਹੀ ਚੰਗੀ ਲੱਗਦੀ ਹੈ